ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਸਿੰਘ ਬੋਲ ਰਿਹਾ ਹਾਂ ਮੈਂ ਤੁਹਾਡੀ ਕੰਪਨੀ ਤੋਂ ਲੈਪਟੋਪ ਮੰਗਵਾਇਆ ਸੀ ਜਿਹੜਾ ਕਿ ਮੇਰੀ ਉਮੀਦਾਂ 'ਤੇ ਪੂਰਾ ਖਰਾ ਉਤਰਿਆ ਹੈ ਮੈਂ ਜਿਹੜਾ ਲੈਪਟੋਪ ਤੁਹਾਡੇ ਤੋਂ ਮੰਗਵਾਇਆ ਸੀ ਉਹਦੀ ਜਿਹੜੀ ਪੈਕਿੰਗ ਵੀ ਬੜੀ ਵਧੀਆ ਸੀ ਅਤੇ ਪੈਕਿੰਗ ਦੇ ਵਿੱਚ ਵਿੱਚ ਜਦੋਂ ਮੈਂ ਉਸ ਨੂੰ ਖੋਲ ਕੇ ਦੇਖਿਆ ਉਹਦੀ ਸਕਰੀਨ ਕੀਬੋਰਡ ਸਾਰੇ ਪ੍ਰੋਡਕਟ ਜਿਹੜੀ ਚੀਜ਼ਾਂ ਹੁੰਦੀਆਂ ਹੈ ਗਈਆਂ ਸੀਗੀਆਂ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਨੂੰ ਤੁਹਾਡੇ ਜਿਹੜਾ ਕੰਪਨੀ ਦਾ ਸੈਲਰ ਆਇਆ ਸੀ ਮੈਨੂੰ ਸਮਝਾਉਣ ਵਾਸਤੇ ਆਇਆ ਸੀ ਉਹਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਉਹਨੇ ਸਮਝਾਇਆ ਅਤੇ ਮੈਂ ਉਸ ਪ੍ਰੋਡਕਟ ਨੂੰ ਹੁਣ ਲੈਪਟੋਪ ਨੂੰ ਮੈਂ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੈਨੂੰ ਆਸ ਪਾਸ ਦੇ ਗੁਆਂਢ ਦੇ ਵਿੱਚ ਵੀ ਕਈ ਜਾਣੇ ਮੇਰੇ ਜਿਹੜੇ ਲੈਪਟੋਪ ਨੂੰ ਦੇਖਣ ਦੇ ਵਿੱਚ ਆਏ ਅਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਖਰੀਦਿਆ ਹੈ ਅਤੇ ਮੈਂ ਤੁਹਾਡਾ ਨਾਮ ਜਿਹੜਾ ਹੈਗਾ ਦੱਸਿਆ ਅਤੇ ਮੈਂ ਹੋਰ ਤੁਹਾਡੇ ਬਾਰੇ ਵੀ ਦੱਸਿਆ ਕਿ ਇਹ ਲੈਪਟੋਪ ਜਿਹੜਾ ਹੈਗਾ ਕੰਪ ਇਸ ਕੰਪਨੀ ਦਾ ਬਹੁਤ ਵਧੀਆ ਹੈ ਅਤੇ ਬਹੁਤ ਹੀ ਇੰਨੇ ਘੱਟ ਖਰਚੇ ਦੇ ਵਿੱਚ ਇੰਨੇ ਜਿਹੜੇ ਹੈਗੇ ਆ ਵਧੀਆ ਫੀਚਰ ਜਿਹਨਾਂ ਨੂੰ ਆਪਾਂ ਕਹਿਦਾਂ ਵੀ ਇੰਨੇ ਵਧੀਆ ਉਹਦੇ ਵਿੱਚ ਗੁਣ ਹਨ ਜਿਹੜੇ ਕਿ ਹੋਰ ਮੈਨੂੰ ਲੈਪਟੋਪਾਂ ਦੇ ਵਿੱਚ ਨਹੀਂ ਮਿਲ ਸਕਦੇ ਸਨ ਮੈਨੂੰ ਇੱਕ ਬਹੁਤ ਹੀ ਘੱਟ ਰੇਟ ਦੇ ਵਿੱਚ ਬੜੀ ਵਧੀਆ ਜਿਹੜਾ ਲੈਪਟੋਪ ਜਿਹੜਾ ਹੈਗਾ ਮਿਲਿਆ ਅਤੇ ਮੈਂ ਤੁਹਾਡੀ ਕੰਪਨੀ ਦਾ ਨਾਮ ਜਿਹੜਾ ਹੈ ਹੋਰ ਪਾਸੇ ਵੀ ਰੀਕਮੈਂਡ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰੀਕੇ ਆਪਣੇ ਜਿਹੜੇ ਹੈ ਗਈ ਪੁਜੀਸ਼ਨ ਬਰਕਰਾਰ ਰੱਖੋਗੇ ਧੰਨਵਾਦ